ਹੈਲੋ ਹਾਂਜੀ ਸਰ ਬੋਲੋ ਹਾਂਜੀ ਜੀ ਦੋ ਸੌ ਛਪੰਜਾ ਨੰਬਰ ਠੀਕ ਹੈ ਜੀ ਟੂਟੀ 'ਚ ਪਾਣੀ ਖ਼ਰਾਬ ਆ ਰਿਹਾ ਤੁਹਾਡੇ ਓਕੇ ਅਤੇ ਮੈਨੂੰ ਜੀ ਮੈਨੂੰ ਦੱਸ ਸਕਦੇ ਹੋ ਪ੍ਰੋਬਲਮ ਤੁਹਾਨੂੰ ਕਦ ਤੋਂ ਆ ਰਹੀ ਹੈ ਪਿਛਲੇ ਵਨ ਮੰਥ ਤੋਂ ਤੁਹਾਡਾ ਨਹੀਂ ਤੁਹਾਡੀ ਮੇਰੇ ਖਿਆਲ 'ਚ ਪੰਦਰਾਂ ਕੁ ਦਿਨ ਪਹਿਲਾਂ ਮੈਂ ਇੱਕ ਮੇਰੇ ਸਿਸਟਮ 'ਤੇ ਆ ਰਹੀ ਤੁਹਾਡੀ ਕੰਪਲੇਂਟ ਇੱਕ ਆਈ ਸੀ ਅਤੇ ਮੈਂ ਵਰਕਰ ਆਪਣੇ ਭੇਜੇ ਵਰਕਰ ਸਾਡੇ ਗਏ ਸੀ ਠੀਕ ਕਰਕੇ ਆਏ ਸੀ ਨਹੀਂ ਤੁਹਾਡੇ ਤੁਹਾਡੇ ਤੁਹਾਡੇ ਇਲਾਕੇ ਚੋਂ ਮੈਨੂੰ ਦੋ ਤਿੰਨ ਕੰਪਲੇਂਟਸ ਹੋਰ ਆਈ ਸੀ ਅਤੇ ਉਹ ਵੀ ਠੀਕ ਕੀਤੀਆਂ ਸੀ ਮੇਰੇ ਹਿਸਾਬ ਨਾਲ਼ ਤਾਂ ਤੁਹਾਡੇ ਉੱਥੇ ਕੰਪਲੇਂਟਸ ਔਲਰੇਡੀ ਠੀਕ ਹੋ ਚੁੱਕੀ ਹੈ ਤੁਸੀਂ ਹੁਣ ਦੁਬਾਰੇ ਫੋਨ ਕੀਤਾ ਓਕੇ ਮਤਲਬ ਪਾਣੀ ਤੁਹਾਡੇ ਆ ਕਿਸ ਤਰ੍ਹਾਂ ਦਾ ਰਿਹਾ ਮੈਨੂੰ ਦੱਸੋ ਉਹਦੇ ਬਾਰੇ ਕੁਛ ਪਾਣੀ ਕਿਵੇਂ ਦਾ ਗੰਦਲਾ ਪਾਣੀ ਆ ਰਿਹਾ ਅਤੇ ਪਾਣੀ ਦਾ ਫਲੋ ਕਿਵੇਂ ਹੈ ਫਲੋ ਠੀਕ ਹੈ ਤੁਹਾਡੇ ਪ੍ਰੈਸ਼ਰ ਪਾਣੀ ਦਾ ਓਕੇ ਅਤੇ ਦੇਖੋ ਹੁਣ ਭਰਾ ਇਸ ਤਰ੍ਹਾਂ ਹੈ ਸਾਡੇ ਕੋਲ ਇਸ ਟਾਈਮ ਬੰਦਾ ਅਵੇਲੇਬਲ ਕੋਈ ਹੈ ਨਹੀਂ ਵਰਕਰ ਜਿਹੜੇ ਹੈਗੇ ਹੈ ਔਲਰੇਡੀ ਫੀਲਡ 'ਚ ਗਏ ਹੋਏ ਨੇ ਅਤੇ ਤੁਹਾਡੇ ਏਰੀਏ 'ਚ ਜਿਹੜੀ ਵਾਰੀ ਹੈਗੀ ਹੈ ਤੁਹਾਡੇ ਇਹਦੇ 'ਚ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਭਰਾ ਸਾਡੇ ਕੋਲੇ ਜਿਹੜੇ ਵਰਕਰ ਹੈਗੇ ਬੜੇ ਘੱਟ ਨੇ ਤੁਹਾਡਾ ਜਿਹੜਾ ਨੰਬਰ ਹੈਗਾ ਆਈ ਥਿੰਕ ਦੋ ਜਾਂ ਤਿੰਨ ਦਿਨ ਲੱਗਣਗੇ ਪ੍ਰੋਬਲਮ ਠੀਕ ਹੋਣ ਵਾਸਤੇ ਐਨੇ ਨੂੰ ਤੁਸੀਂ ਟੈਂਪਰੇਰੀ ਅਰੇਂਜਮੈਂਟ ਕੋਈ ਹੋਰ ਆਪਣਾ ਕਰ ਲਉ ਚਲੋ ਮੈਂ ਤੁਹਾਡਾ ਨਾਮ ਤੁਹਾਡਾ ਕਨੈਕਸ਼ਨ ਨੰਬਰ ਵਗੈਰਾ ਤੁਹਾਡਾ ਨੋਟ ਕਰ ਲਿਆ ਅਸੀਂ ਕੋਸ਼ਿਸ਼ ਕਰਦੇ ਜਿੰਨੀ ਜਲਦੀ ਹੋ ਸਕੇ ਤੁਹਾਡੀ ਆਹ ਪ੍ਰੋਬਲਮ ਸਾਰਟ ਆਊਟ ਕਰਾਉਣ ਦੀ ਠੀਕ ਹੈ ਜੀ ਓਕੇ ਜੀ ਓਕੇ